ਹੈਲੋ ਹੈਲੋ ਹੈਲੋ ਵਧੀਆ ਵਧੀਆ ਕੀ ਹਾਲ ਨੇ ਵਧੀਆ ਵਧੀਆ ਬਠਿੰਡੇ ਯਾਰ ਅਗਲੇ ਹਫ਼ਤੇ ਆਉਂਗਾ ਹਾਂ ਹਾਂ ਮੇਰਾ ਵੀ ਪਲੈਨ ਸੀਗਾ ਯਾਰ ਵੀ ਇੱਥੋਂ ਦਾ ਆਪਾਂ ਨਾ ਦੇਖੀਏ ਇੱਥੋਂ ਦੇ ਇਤਿਹਾਸ ਬਾਰੇ ਦਾ ਆਪਾਂ ਨੂੰ ਪਤਾ ਹੋਵੇ ਜਿੱਥੇ ਆਪਾਂ ਰਹਿੰਦੇ ਹਾਂ ਅਤੇ ਕਿਹੜੀਆਂ ਕਿਹੜੀਆਂ ਥਾਵਾਂ ਤੈਨੂੰ ਲੱਗਦਾ ਕਿ ਜ਼ਿਆਦਾ ਪਹਿਲਾਂ ਜਾਣਾ ਚਾਹੀਦਾ ਦੇਖਣ ਲਈ ਜਾਂ ਵਧੀਆ ਥਾਂ ਕਿਹੜੇ ਕਿਹੜੇ ਆ ਅੱਛਾ ਠੀਕ ਹਾਜੀ ਰਤਨ ਵੀ ਹੋ ਗਿਆ ਅੱਛਾ ਠੀਕ ਆ ਠੀ ਅੱਛਾ ਠੀਕ ਆ ਅੱਛਾ ਉੱਥੇ ਲ ਹਾਂ ਹਾਂ ਦਮਦਮਾ ਉੱਦਾ ਤਾਂ ਜਾਣਦੇ ਹਾਂ ਪਰ ਦੇਖਿਆ ਨਹੀਂ ਨਾ ਮੈਂ ਕਦੇ ਗਿਆ ਨਹੀਂ ਯਾਰ ਉੱਥੇ ਵੀ ਚੱਲ ਜੇ ਤੇਰੇ ਨਾਲ ਨਾਲ ਗਿਆ ਤਾਂ ਬੰਦਾ ਦੱਸਦਾ ਹੀ ਰਹਿੰਦਾ ਚੱਲ ਵੀ ਇੱਧਰ ਆਹ ਬਣਿਆ ਜਾਣਾ ਆਉਣਾ ਸੌਖਾ ਹੋ ਜਾਂਦਾ ਠੀਕ ਆ ਹਾਂ ਫਿਰ ਉੱਥੇ ਰੁਕਣ ਦਾ ਵੀ ਬਣ ਸਕਦਾ ਇੱਕ ਰਾਤ ਅੱਛਾ ਠੀਕ ਆ ਠੀਕ ਆ ਠੀਕ ਆ ਠੀਕ ਆ ਹਾਂ ਫਿਰ ਐਂ ਆਂ ਰਾਤ ਇੱਥੇ ਰਹਿ ਕੇ ਚੱਲ ਅਗਲੇ ਦਿਨ ਫਿਰ ਦੇਖ ਆਵਾਂਗੇ ਹਾਂ ਅਗਲੇ ਵੀਕਐਂਡ ਦਾ ਪੱਕਾ ਫਿਰ ਹਾਂ ਟਾਈਮ ਕੱਢ ਕੇ ਰੱਖੀ ਫਿਰ ਸ਼ਨੀ ਐਤਵਾਰ ਜਾਵਾਂਗੇ ਪੱਕਾ ਹਾਂ ਠੀਕ ਆ ਓਕੇ ਓਕੇ ਠੀਕ ਆ